ਹੈਲੋ ਨਮਸਕਾਰ ਜੀ ਦੇਖੋ ਨਨਕਾਣਾ ਸਾਹਿਬ ਜਿਹੜਾ ਹੈਗਾ ਨਾ ਉਹ ਪਾਕਿਸਤਾਨ ਦੇ ਵਿੱਚ ਹੈਗਾ ਪਹਿਲੇ ਸਾਡਾ ਮਤਲਬ ਕਿ ਪਾਕਿਸਤਾਨ ਜਾਣਾ ਬਹੁਤ ਹੀ ਔਖਾ ਸੀਗਾ ਪਰ ਹੁਣ ਅਸੀਂ ਜਾ ਸਕਦੇ ਹਾਂ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਹੈ ਸਾਡਾ ਏ ਉੱਦੋਂ ਜ਼ਿਆਦਾ ਸੌਖਾ ਕਰ ਦਿੱਤਾ ਕੋਰੀਡੋਰ ਦੇ ਰਾਹੀਂ ਠੀਕ ਹੈ ਜੇ ਤੁਸੀਂ ਜਾਣਾ ਤਾਂ ਤੁਸੀਂ ਔਨਲਾਈਨ ਰਜਿਸਟ੍ਰੇਸ਼ਨ ਆਪਣੀ ਕਰਵਾ ਦਿਓ ਕਿਉਂਕਿ ਹੁਣ ਤਾਂ ਉਹ ਖੁੱਲਣ ਵਾਲਾ ਹੋਵੇ ਅਤੇ ਤੁਹਾਨੂੰ ਜਿਹੜੀ ਹੈ ਸਹੂਲਤ ਮਿਲ ਜੇਗੀ ਅਤੇ ਤੁਸੀਂ ਆਸਾਨੀ ਨਾਲ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਠੀਕ ਹੈ ਜੇ ਤੁਹਾਡੀ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਧੰਨਵਾਦ ਜੀ